ਭਾਰਤ ਦੇ ਵਿੱਚ ਬਹੁਤ ਹੀ ਥਾਵਾਂ ਹਨ ਜਿੱਥੇ ਅਸੀਂ ਸੈਕਲ ਦੇ ਰਾਹੀ ਗਏ ਹਾਂ ਜਿਵੇਂ ਕਿ ਰਾਜਸਥਾਨ ਕਿਉਂਕਿ ਇਹ ਥਾਵਾਂ ਸਾਡੇ ਰਾਜ ਦੇ ਬਹੁਤ ਜ਼ਿਆਦਾ ਨਜ਼ਦੀਕ ਹਨ ਜਿਸ ਕਰਕੇ ਅਸੀਂ ਆਰਾਮ ਦੇ ਨਾਲ ਸਾਈਕਲ ਰਾਹੀਂ ਉੱਥੇ ਗਏ ਅਤੇ ਉੱਥੇ ਬਹੁਤ ਜ਼ਿਆਦਾ ਘੁੰਮੇ ਫਿਰੇ ਅਤੇ ਉੱਥੋਂ ਦੇ ਅਸੀਂ ਸੱਭਿਅਤਾ ਨੂੰ ਜਾਣਿਆ ਜਿਸਾਂ ਜਿਸ ਕਰਕੇ ਸਾਡੀ ਬਹੁਤ ਹੀ ਜ਼ਿਆਦਾ ਨੌਲੇਜ ਦੇ ਵਿੱਚ ਵਾਧਾ ਹੋਇਆ ਅਤੇ ਇੱਕ ਹੋਰ ਅਸਥਾਨ ਹੈ ਜਿਵੇਂ ਕਿ ਹਿਮਾਚਲ ਪ੍ਰਦੇਸ਼ ਇਹ ਸਥਾਨ ਵੀ ਸਾਡੇ ਰਾਜ ਦੇ ਬਿਲਕੁਲ ਨਜ਼ਦੀਕ ਹੈ ਅਤੇ ਅਸੀਂ ਇੱਥੇ ਸੈਕਲ ਰਾਹੀਂ ਗਏ ਕਿਉਂਕਿ ਉਹ ਪਹਾੜੀ ਇਲਾਕਾ ਹੈ ਜਿਸ ਕਰਕੇ ਮੈਂ ਅਤੇ ਮੇਰੇ ਦੋਸਤਾਂ ਨੇ ਬਹੁਤ ਜ਼ਿਆਦਾ ਮਜ਼ਾ ਕੀਤਾ ਧੰਨਵਾਦ